ਹਾਂਜੀ ਮੈਨੂੰ ਲਗਦਾ ਹੈ ਕਿ ਕੈਮੀਕਲ ਕੀਟਨਾਸ਼ਕ ਮਿੱਟੀ ਨੂੰ ਦਿਨ ਪਰ ਦਿਨ ਬਹੁਤ ਹੀ ਡੂੰਘੇ ਤਰੀਕੇ ਨਾਲ਼ ਬਰਬਾਦ ਕਰਦੇ ਜਾ ਰਹੇ ਹਨ ਕੁਝ ਬਹੁਤ ਹੀ ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤੀਬਾੜੀ ਦੇ ਵਿੱਚ ਵਰਤੇ ਜਾਂਦੇ ਕੀਟਨਾਸ਼ਕ ਜੋ ਕਿ ਬਹੁਤ ਹੀ ਖਤਰਨਾਕ ਘਾਤਕ ਸਿੱਧ ਹੁੰਦੇ ਹਨ ਕੈਮੀਕਲ ਕੀਟਨਾਸ਼ਕ ਕੁਝ ਅਜਿਹੇ ਵੀ ਹਨ ਜੋ ਸਰਕਾਰ ਵੱਲੋਂ ਬੈਨ ਕਰ ਦਿੱਤੇ ਗਏ ਹਨ ਪਰ ਫਿਰ ਵੀ ਜਿੰਮੀਦਾਰ ਜਾਂ ਕਿਸਾਨ ਭਾਈਆਂ ਵੱਲੋਂ ਉਸਦੀ ਵਰਤੋਂ ਕੀਤੀ ਜਾ ਰਹੀ ਹੈ ਹੁਣ ਜਿਵੇਂ ਕਿ ਦੇਖਿਆ ਜਾਵੇ ਕੱਖ ਵਾਲੀਆਂ ਦਵਾਈਆਂ ਹੋ ਗਈਆਂ ਰਾਊਂਡਅੱਪ ਹੋ ਗਈ ਜਾਂ ਗਰਾਮੋਕਸੋਨ ਹੋ ਗਈ ਜਾਂ ਕੁਛ ਅਜਿਹੀਆਂ ਕੀਟਨਾਸ਼ਕ ਦਵਾਈਆਂ ਜਿਵੇਂ ਕਲੋਰੋ ਹੋ ਗਈ ਇਹਨਾਂ ਨੂੰ ਸਰਕਾਰ ਨੇ ਬੈਨ ਕਰ ਦਿੱਤਾ ਹੈ ਪਰ ਫਿਰ ਵੀ ਇਹ ਜਿੰਮੀਦਾਰ ਨੇ ਜਾਂ ਜੋ ਕਿਸਾਨ ਨੇ ਉਹ ਮੌਜੂਦ ਵਿੱਚ ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ ਜੋ ਕਿ ਮਿੱਟੀ ਨੂੰ ਵੀ ਬਹੁਤ ਜ਼ਿਆਦਾ ਬਰਬਾਦ ਕਰ ਰਹੇ ਹਨ ਅਤੇ ਨਾਲ਼ ਨਾਲ਼ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਵਾ ਪਾਣੀ ਕੁਦਰਤ ਸਭ ਨੂੰ ਬਦਰ ਬਰਬਾਦ ਕਰਦੇ ਹਨ ਬਦਲਾਅ ਤਾਂ ਅੱਜ ਦੇ ਟਾਈਮ ਦੇ ਵਿੱਚ ਕੋਈ ਦੇਖਿਆ ਨਹੀਂ ਗਿਆ ਹਾਂ ਬਦਲਾਅ ਆਇਆ ਹੈ ਪਹਿਲਾਂ ਵਾਲੇ ਪੁਰਾਣੇ ਸਮੇਂ ਦੇ ਵਿੱਚ ਲੋਕ ਬਿਨ੍ਹਾਂ ਕੀਟਨਾਸ਼ਕਾਂ ਤੋਂ ਬਿਨ੍ਹਾਂ ਕੈਮੀਕਲ ਕੀਟਨਾਸ਼ਕਾਂ ਤੋਂ ਮਿੱਟੀ ਤੋਂ ਮਿੱਟੀ ਦੇ ਵਿੱਚ ਫਸਲ ਕੱਢ ਕੇ ਸ ਸੋਨਾ ਤਿਆਰ ਕਰ ਲੈਂਦੇ ਸੀ ਸੋਨੇ ਵਰਗੀ ਫਸਲ ਕੱਢਦੇ ਹੁੰਦੇ ਸੀ ਅੱਜ ਦੇ ਟਾਈਮ ਦੇ ਵਿੱਚ ਇਸ ਦਾ ਇਲਾਜ਼ ਇਹ ਹੈ ਕਿ ਘੱਟ ਤੋਂ ਘੱਟ ਕੀਟਨਾਸ਼ਕਾਂ ਵਰਤੀਆਂ ਜਾਣ ਘੱਟ ਤੋਂ ਘੱਟ ਕੈਮੀਕਲ ਵਰਤਿਆ ਜਾਵੇ ਫਸਲਾਂ ਦੇ ਉੱਤੇ ਜੋ ਕਿ ਮਿੱਟੀ ਨੂੰ ਵੀ ਨੁਕਸਾਨ ਨਾ ਪਹੁੰਚਾ ਸਕੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਵੱਧ ਤੋਂ ਵੱਧ ਦੇਸੀ ਤਰੀਕੇ ਨਾਲ਼ ਖੇਤੀ ਜਾਂ ਦੇਸੀ ਕੀਟਨਾਸ਼ਕ ਵਰਤੇ ਜਾਣ